ਦਸ ਜੂਨ ਉੱਨੀ ਸੌ ਸਤਾਸੀ ਤੇਰਾਂ ਨਵੰਬਰ ਉੱਨੀ ਸੌ ਬਾਨਵੇਂ ਚੌਦਾਂ ਜੁਲਾਈ ਦੋ ਹਜ਼ਾਰ ਪੰਦਰਾਂ ਤੇਰਾਂ ਅਕਤੂਬਰ ਦੋ ਹਜ਼ਾਰ ਅਠਾਰਾਂ ਉੱਨੀ ਨਵੰਬਰ ਦੋ ਹਜ਼ਾਰ ਚੌਵੀ